ਗਤਕਾ ਸਿੱਖ ਧਰਮ ਅੰਦਰ ਸ਼ਾਸਤਰ ਵਿੱਦਿਆ ਨੂੰ ਗਤਕਾ ਨਾਮ ਨਾਲ ਵੀ ਪੁਕਾਰਿਆ ਜਾਂਦਾ ਪਰ ਗਤਕਾ ਇੱਕ ਅਲੱਗ ਸ਼ਾਸਤਰ ਹੈ ਜੋ ਲੰਬਾਈ ਵਿੱਚ ਛੱਤੀ ਇੰਚ ਦੀ ਸੋਟੀ ਜਿਸ ਉੱਪਰ ਕੱਪੜੇ ਦੀ ਜਾਂ ਸੂਤੀ ਨਿਵਾਰ ਚਮੜਾ ਜਾਂ ਫਿਰ ਪਲਾਸਟਿਕ ਕਵਰ ਕੀਤਾ ਹੁੰਦਾ ਹੈ ਅਤੇ ਮੁੱਠ ਉਪਰ ਹੱਥ ਤੋਂ ਬਚਾਅ ਲਈ ਇੱਕ ਗੋਲ ਲਾਟੂ ਅਤੇ ਹੇਠਾਂ ਇੱਕ ਪਲਜ ਲੱਗੀ ਹੁੰਦੀ ਹੈ ਜਿਸ ਉੱਪਰ ਕੱਪੜੇ ਦਾ ਚਮੜੇ ਦਾ ਕਵਰ ਲੱਗਿਆ ਹੁੰਦਾ ਹੈ ਗਤਕਾ ਪੰਜਾਬ ਵਿੱਚ ਕਾਫੀ ਮਸ਼ਹੂਰ ਹੈ ਪੰਜਾਬ ਵਿੱਚ ਗਤਕਾ ਸਿੱਖ ਇਤਿਹਾਸ ਦੇ ਉੱਪਰ ਕਾਫੀ ਵਧੀਆ ਅਸਰਦਾਰ ਸਾਬਿਤ ਹੋਇਆ ਹੈ ਗਤਕਾ ਹਰੇਕ ਮਾਰਦ ਜਾਂ ਔਰਤ ਨੂੰ ਸਿਖਣਾ ਚਾਹੀਦਾ ਹੈ ਗਤਕੇ ਦੀਆਂ ਪੰਜਾਬ ਵਿੱਚ ਕਾਫੀ ਅਕੈਡਮੀਆਂ ਹਨ ਗੁਰੂ ਗੋਬਿੰਦ ਸਿੰਘ ਅਕੈਡਮੀ ਗੁਰੂ ਹਰਗੋਬਿੰਦ ਜੀ ਅਕੈਡਮੀ ਕਰਮ ਸਿੰਘ ਗਤਕਾ ਅਕੈਡਮੀ ਕਾਪੂਰਥਲੇ ਵਿੱਚ ਬਾਬਾ ਬੁੱਢਾ ਜੀ ਗਤਕਾ ਅਕੈਡਮੀ ਦੇਖਣ ਨੂੰ ਮਿਲੀਆਂ ਹਨ ਇੱਥੇ ਕੋਈ ਵੀ ਗਤਕਾ ਜਾ ਕੇ ਸਿੱਖ ਸਕਦਾ ਹੈ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਨੂੰ ਗਤਕਾ ਸਿਖਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਬਾਹਰ ਦੇ ਹਾਲਾਤ ਵਿਗੜ ਗਏ ਹਨ ਔਰਤਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਬਲਾਤਕਾਰ ਕੇਸ ਦਿਨੋਂ ਦਿਨ ਵਧਦੇ ਜਾ ਰਹੇ ਹਨ ਇਸ ਲਈ ਔਰਤਾਂ ਨੂੰ ਆਪਣੀ ਸੁਰੱਖਿਆ ਦੇ ਲਈ ਗਤਕਾ ਸਿੱਖਣਾ ਚਾਹੀਦਾ ਹੈ ਤਾਂ ਜੋ ਆਪਣੀ ਉਹ ਇਫਾਜ਼ਤ ਆਪ ਕਰ ਸਕਣ ਵੈਸੇ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਗਤਕਾਂ ਸਿਖਾਉਣ ਲਈ ਤਿਆਰ ਬਰ ਤਿਆਰ ਰਹਿੰਦੀਆਂ ਹਨ ਗਤਕਾ ਫੈਡਰਸ਼ਨ ਆਫ ਇੰਡੀਆ ਦੇ ਕੀਤੇ ਜਾ ਰਹੇ ਉਪਰਾਲੇ ਅਤੇ ਕੋਸ਼ਿਸ਼ਾਂ ਸਦਕਾ ਗਤਕਾ ਇਕ ਰਾਸਟਰੀ ਖੇਡ ਬਣ ਚੁੱਕੀ ਹੈ ਗਤਕਾ ਨੂੰ ਉਲੰਪਿਕ ਖੇਡਾਂ ਵਿੱਚ ਵੀ ਸਾਮਿਲ ਕੀਤਾ ਗਿਆ ਹੈ ਜਿਸ ਨਾਲ ਸਿੱਖ ਇਤਿਹਾਸ ਵਿੱਚ ਹੋਰ ਵੀ ਗਤਕੇ ਦਾ ਨਾਮ ਉੱਚਾ ਹੋਇਆ ਹੈ ਗਤਕੇ ਨੂੰ ਦੇਖਣ ਲਈ ਹੋਲੇ ਮਹੱਲੇ 'ਤੇ ਗਤਕਾ ਖੇਡਿਆ ਜਾਂਦਾ ਹੈ ਤੁਸੀਂ ਗਤਕਾ ਪ੍ਰਦਰਸ਼ਨ ਦੇਖ ਸਕਦੇ ਹੋ ਗਤਕਾ ਨਗਰ ਕੀਰਤਨ ਦੌਰਾਨ ਖੇਡਿਆ ਜਾਂਦਾ ਹੈ ਜਾਂ ਗੁਰੂ ਸਟਡੀ ਸਰਕਲ ਜੋ ਪਿੰਡਾਂ ਵਿੱਚ ਕੈਂਪ ਲਗਾਏ ਜਾਂਦੇ ਹਨ ਉੱਥੇ ਵੀ ਗਤਕਾ ਦੇਖਿਆ ਜਾ ਸਕਦਾ ਹੈ ਗਤਕਾ ਹਰ ਸਾਲ ਜਦੋਂ ਵੀ ਕੋਈ ਵੱਡਾ ਤਿਉਹਾਰ ਪੁਰਬ ਸਿੱਖ ਇਤਿਹਾਸ ਵਿੱਚ ਹੁੰਦਾ ਹੈ ਉਦੋਂ ਗਤਕਾ ਖੇਡਿਆ ਜਾਂਦਾ ਹੈ ਗਤਕਾ ਛੋਟੀ ਉਮਰ ਦੇ ਬੱਚਿਆਂ ਦੁਆਰਾ ਵੀ ਮਰਦਾਂ ਦੁਆਰਾ ਔਰਤਾਂ ਦੁਆਰਾ ਵੀ ਖੇਡਿਆ ਜਾਂਦਾ ਹੈ ਜਦੋਂ ਵੀ ਕੋਈ ਮਹਾਨ ਸਿੱਖ ਇਤਿਹਾਸ ਦਾ ਕੋਈ ਪੁਰਬ ਹੁੰਦਾ ਹੈ ਉਦੋਂ ਗਤਕਾ ਵਿਸ਼ੇਸ਼ ਅਤੇ ਸ਼ਰਧਾਪੂਰਵਕ ਖੇਡਿਆ ਜਾਂਦਾ ਇਸ ਨਾਲ ਆਪਣੇ ਜੋਹਰ ਦਿਖਾਏ ਜਾਂਦੇ ਹਨ ਗਤਕਾ ਵੀਰਾਂ ਭੈਣਾਂ ਵੱਲੋਂ ਅਤੇ ਗੱਤਕੇ ਦੀ ਕਲਾ ਦਾ ਜੋਹਰ ਹੋਰ ਦਿਖਾਇਆ ਜਾਂਦਾ ਹੈ